ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਬਹੁਤ ਮਸ਼ਹੂਰ ਹੁੰਦੀ ਜਾਂਦੀ ਹੈ ਕਿਉਂਕਿ ਉੱਥੇ ਬਹੁ ਜ਼ਿਆਦਾ ਡਿਸਕਾਊਂਟ ਮਿਲਦੇ ਆ ਅਤੇ ਉਹ ਬਹੁਤ ਜ਼ਿਆਦਾ ਮਦਦ ਫੁੱਲ ਹੁੰਦੀ ਹੈ ਕਿਉਂਕਿ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਉਹ ਘਰ ਤੋਂ ਬੈਠੇ ਸ਼ੋਪਿੰਗ ਕਰ ਸਕਦੇ ਹਾਂ ਅਤੇ ਮੈਨੂੰ ਯਾਦ ਆ ਕਿ ਪਿਛਲੇ ਸਾਲ ਦਿਵਾਲੀ 'ਤੇ ਬਹੁਤ ਤਕੜਾ ਔਫਰ ਚੱਲ ਰਿਹਾ ਸੀਗਾ ਐਮਾਜ਼ੋਨ 'ਤੇ ਉਹ ਸਾਰਿਆਂ ਤੋਂ ਮਸ਼ਹੂਰ ਐਪਲੀਕੇਸ਼ਨ ਆ ਸਾਡੇ ਦੇਸ਼ ਦੇ ਵਿੱਚ ਅਤੇ ਉਹਦੇ ਕਰਕੇ ਮੈਂ ਸਲਾਹ ਬਣਾਈ ਮੈਂ ਉੱਥੇ ਇੱਕ ਪੈਂਟ ਖਰੀਦਾਂ ਕਿਉਂਕਿ ਮੈਂ ਕਦੀ ਨਹੀਂ ਉੱਥੋਂ ਪੈਂਟ ਖਰੀਦੀ ਸੀਗੀ ਅਤੇ ਉੱਥੋਂ ਬਹੁਤ ਜ਼ਿਆਦਾ ਡਿਸਾਈਡ ਕਰਨ ਤੋਂ ਬਾਅਦ ਜਦੋਂ ਮੈਂ ਉੱਥੇ ਜ਼ਿਆਦਾ ਬਹੁਤ ਜ਼ਿਆਦਾ ਸਕਰੋਲ ਕੀਤਾ ਅਤੇ ਉੱਥੇ ਜਾਣ ਕੇ ਦੇਖ ਕੇ ਆਇਆ ਕਿ ਉੱਥੇ ਇੱਕ ਦੋ ਹਜ਼ਾਰ ਦੀ ਪੈਂਟ ਸੀਗੀ ਅਤੇ ਉਹ ਵੀਸਾਚੇ ਕੰਪਨੀ ਦੀ ਸੀਗੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਿਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਡਿਸਕਾਊਂਟ ਸੀ ਤਿੰਨ ਹਜ਼ਾਰ ਦਾ ਫਲੈਟ ਡਿਸਕਾਊਂਟ ਸੀਗਾ ਅਤੇ ਉਸ ਤੋਂ ਬਾਅਦ ਜਦੋਂ ਮੈਂ ਸਿੱਧਾ ਉਹ ਔਡਰ ਕਰਤੀ ਆਪਣਾ ਸਾਈਜ਼ ਸੁਈਜ਼ ਦੇਖ ਕੇ ਅਤੇ ਮੈਨੂੰ ਸੁਣਨ 'ਚ ਆਇਆ ਸੀਗਾ ਉਹ ਸਟਰੇਟ ਫਿੱਟ ਸੀਗੀ ਕਦੋਂ ਮੈਂ ਪੂਰਾ ਹਫ਼ਤਾ ਵੇਟ ਕੀਤੀ ਉਹ ਉਹ ਪੈਂਟ ਨੂੰ ਪਾਉਣ ਲਈ ਕਿਉਂਕਿ ਮੈਂ ਇੱਕ ਵਿਆਹ 'ਤੇ ਜਾਣਾ ਸੀਗਾ ਉਹ ਪੈਂਟ ਪਾ ਕੇ ਅਤੇ ਉਸ ਉਸ ਕਰਕੇ ਮੈਂ ਪੂਰਾ ਹਫ਼ਤਾ ਵੇਟ ਕੀਤੀ ਅਤੇ ਜਦੋਂ ਮੈਂ ਪਾਰਸਲ ਆਪਣੇ ਰਿਸੀਵ ਕੀਤਾ ਮੈਂ ਉਹਨਾਂ ਨੂੰ ਪੈਸੇ ਭੇਜੇ ਅਤੇ ਕਦੋਂ ਮੈਂ ਘਰ ਆ ਕੇ ਖੋਲ੍ਹਿਆ ਅਤੇ ਉਹ ਪੈਂਟ ਦਾ ਸਾਈਜ਼ ਬਹੁਤ ਵੱਡਾ ਸੀਗਾ ਅਤੇ ਉੱਥੇ ਉੱਥੇ ਹੋਰ ਅਤੇ ਹੋਰ ਉਹ ਪੈਂਟ ਸਟਰੇਟ ਫਿੱਟ ਦੀ ਜਗ੍ਹਾ ਨੈਰੋ ਸੀਗੀ ਅਤੇ ਮੈਂ ਉਹਨੂੰ ਦੇਖ ਕੇ ਬੜਾ ਬੜਾ ਸੈਡ ਹੋ ਗਿਆ ਅਤੇ ਉਹਦੇ ਕਾਰਨ ਨਾ ਮੈਂ ਸਲਾਹ ਕੀਤੀ ਕਿ ਇਹਨੂੰ ਪੈਂਟ ਨੂੰ ਵਾਪਿਸ ਕੀਤਾ ਜਾਵੇ ਕਿਉਂਕਿ ਆਹ ਪੈਂਟ ਮੇਰੇ ਕੋਈ ਯੂਜ਼ਫੁੱਲ ਨਹੀਂ ਹੈਗੀ ਪਰ ਉਸ ਤੋਂ ਬਾਅਦ ਜਦੋਂ ਮੈਨੂੰ ਉਹ ਵੀ ਜਾਣ ਕੇ ਪਤਾ ਲੱਗਿਆ ਕਿ ਉੱਥੇ ਰਿਫੰਡ ਪੋਲਿਸੀ ਨਹੀਂ ਹੈਗੀ ਆਪਾਂ ਉਹ ਪੈਂਟ ਮੋੜ ਨਹੀਂ ਸਕਦੇ ਤਾਂ ਉੱਥੇ ਮੇਰੇ ਦੋ ਹਜ਼ਾਰ ਰੁਪਏ ਪੂਰੇ ਖ਼ਰਾਬ ਹੋ ਗਏ ਸੀਗੇ ਅਤੇ ਜਦੋਂ ਤੋਂ ਬਾਅਦ ਮੈਂ ਇਹ ਸਲਾਹ ਬਣਾਈ ਆ ਪੈਂਟ ਲੋੜਵੰਦ ਨੂੰ ਦਿੱਤੀ ਜਾਵੇ ਅਤੇ ਮੈਨੂੰ ਮੈਂ ਰਸਤੇ 'ਚ ਤੁਰਿਆ ਜਾ ਰਿਹਾ ਸੀਗਾ ਅਤੇ ਉੱਥੇ ਇੱਕ ਮੁੰਡਾ ਸੀਗਾ ਜੀਹਦੇ ਕੋਲ ਫਟੇ ਕੱਪੜੇ ਸੀਗੇ ਅਤੇ ਮੈਂ ਉਹਨੂੰ ਪੈਂਟ ਦੇ ਦਿੱਤੀ ਅਤੇ ਉਹ ਖੁਸ਼ ਹੋ ਗਿਆ ਉਹਦੀ ਦਿਵਾਲੀ ਬਣ ਗਈ